ਸਤਿ ਸ਼੍ਰੀ ਅਕਾਲ ਮੇਰਾ ਨਾਮ ਅੰਸ਼ ਮਹਾਜਨ ਹੈ ਮੈਂ ਪਠਾਨਕੋਟ ਸ਼ਹਿਰ ਦਾ ਰਹਿਣ ਵਾਲਾ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਖੇਡਾਂ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ ਅਤੇ ਲੋਕ ਪੰਜਾਬ ਦੇ ਖੇਡਾਂ ਨੂੰ ਕਿੰਨੀ ਰੁਚੀ ਨਾਲ ਦੇਖਦੇ ਨੇ ਪਰ ਅੱਜ ਵੀ ਪੰਜਾਬ ਦੇ ਕਾਫ਼ੀ ਜ਼ਿਲ੍ਹਿਆਂ ਵਿੱਚ ਬੱਚਿਆਂ ਨੂੰ ਇਹ ਤੱਕ ਨਹੀਂ ਪਤਾ ਕਿ ਕਿਹੜੀ ਖੇਡ ਨੂੰ ਖੇਡਣ ਦਾ ਕਿਹੜਾ ਸਹੀ ਢੰਗ ਹੁੰਦਾ ਹੈ ਜੋ ਕਿ ਬਹੁਤ ਹੀ ਗਲਤ ਗੱਲ ਹੈ ਇਹ ਇਸ ਲਈ ਹੈ ਕਿਉਂਕਿ ਪੰਜਾਬ ਦੇ ਕਾਫ਼ੀ ਜ਼ਿਲ੍ਹਿਆਂ ਵਿੱਚ ਅੱਜ ਵੀ ਸਹੀ ਟੈਕਨੋਲੋਜੀ ਵਾਲੇ ਕੋਚਿੰਗ ਸੈਂਟਰ ਨਹੀਂ ਖੁਲ੍ਹੇ ਦੇ ਅਤੇ ਇਸ ਨੂੰ ਦੂਰ ਕਰਨ ਵਾਸਤੇ ਸਾਡੀ ਸਰਕਾਰ ਨੂੰ ਹਰ ਜਿਲ੍ਹੇ ਵਿੱਚ ਇੱਕ ਵਧੀਆ ਟੈਕਨੋਲੋਜੀ ਵਾਲਾ ਕੋਚਿੰਗ ਸੈਂਟਰ ਖੋਲਣਾ ਚਾਹੀਦਾ ਹੈ ਜਿਸ ਵਿੱਚ ਇੱਕ ਸਹੀ ਕੋਚ ਹੋਵੇ ਜਿਹੜਾ ਜਿਹੜਾ ਸਾਡੇ ਪੰਜਾਬ ਦੇ ਬੱਚਿਆਂ ਨੂੰ ਹੋਰ ਅੱਗੇ ਲੈ ਕੇ ਜਾਵੇ ਖੇਡਾਂ ਵਿੱਚ ਅਤੇ ਸਾਡਾ ਪੰਜਾਬ ਵੀ ਖੇਡਾਂ ਵਿੱਚ ਹੋਰ ਅੱਗੇ ਵਧੇ ਉਹ ਕੋਚਿੰਗ ਸੈਂਟਰਾਂ ਵਿੱਚ ਖੇਡਾਂ ਦੀ ਸਮ ਸਮਾਨ ਦੀ ਸਹੀ ਮਾਤਰਾ ਹੋਣੀ ਚਾਹੀਦੀ ਹੈ ਅਤੇ ਖੇਡਾਂ ਵਿੱਚ ਸਮਾਨ ਬਿਲਕੁਲ ਟੈਕਨੋਲੋਜੀ ਸਹੀ ਹੋਣੀ ਚਾਹੀਦੀ ਹੈ ਉਹਨਾਂ ਦੀ ਅਤੇ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਜੇ ਤਾਂ ਸਾਡਾ ਪੰਜਾਬ ਖੇਡਾਂ ਵਿੱਚ ਅੱਗੇ ਜਾਣਾ ਚਾਹੁੰਦਾ ਤਾਂ ਸਾਡੇ ਸਰਕਾਰ ਨੂੰ ਇਹ ਸਟੈੱਪ ਚੁੱਕਣੇ ਪੈਣਗੇ ਨਹੀਂ ਤਾਂ ਸਾਡਾ ਪੰਜਾਬ ਖੇਡਾਂ ਵਿੱਚ ਪਿੱਛੇ ਹੀ ਰਹਿ ਜਾਵੇਗਾ ਸ਼ੁਕਰੀਆ